ਮੋਹਾਲੀ ਜ਼ਿਲ੍ਹੇ ਦੇ ਮੌਸਮ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਇਹ ਇੱਥੇ ਮਤਲਬ ਮੌਸਮ ਬਹੁਤ ਵਧੀਆ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲੋਂ ਮੋਹਾਲੀ ਜ਼ਿਲ੍ਹੇ ਵਿੱਚ ਮੌਸਮ 'ਚ ਘੱਟ ਹੀ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਹਨ ਇੱਥੇ ਜਿਵੇਂ ਕਿ ਤੁਸੀਂ ਦੇਖਿਆ ਹੀ ਹੋਵੇਗਾ ਕਿ ਹਰਿਆਲੀ ਜ਼ਿਆਦਾ ਹੈ ਜਿਸ ਕਰਕੇ ਮੌਸਮ ਇੱਥੇ ਸਾਫ ਰਹਿੰਦਾ ਅਤੇ ਬਾਰਿਸ਼ ਵੀ ਇੱਥੇ ਮਤਲਬ ਠੀਕ ਹੁੰਦੀ ਹੈ ਮਤਲਬ ਜ਼ਿਆਦਾ ਜ਼ਿਆਦਾ ਨਹੀਂ ਹੁੰਦੀ ਜਿਹਦਾ ਆਪਾਂ ਨੂੰ ਨੁਕਸਾਨ ਹੋਵੇ ਪਰ ਇੱਕ ਦੋ ਸਾਲ ਤੋਂ ਇੱਥੇ ਦੇਖਿਆ ਜਾਵੇ ਤਾਂ ਮੌਸਮ 'ਚ ਤਬਦੀਲੀਆਂ ਆ ਰਹੀਆਂ ਹਨ ਜਿਵੇਂ ਕਿ ਹੁਣ ਰੀਸੈਂਟਲੀ ਹ ਹੜ੍ਹ ਵਗੈਰਾ ਵੀ ਆਏ ਸੀ ਹੋਰ ਜ਼ਿਲ੍ਹਿਆਂ 'ਚ ਅ ਜ਼ਿਲ੍ਹਿਆਂ ਵਿੱਚ ਵੀ ਆਏ ਸੀ ਪਰ ਮੋਹਾਲੀ 'ਚ ਵੀ ਆਏ ਦੂਜੇ ਦਿਲਆਂ ਜ਼ਿਲ੍ਹਿਆਂ ਤੋਂ ਘੱਟ ਸੀ ਪਰ ਆਏ ਜ਼ਰੂਰ ਸੀ ਪਰ ਇੰਨਾਂ ਨੁਕਸਾਨ ਵੀ ਨਹੀਂ ਹੋਇਆ ਅਤੇ ਬਾਕੀ ਇੱਥੇ ਸ਼ਾਮ ਨੂੰ ਦੇਖਿਆ ਜਾਵੇ ਤਾਂ ਮੌਸਮ ਬਹੁਤ ਹੀ ਵਧੀਆ ਹੁੰਦਾ ਖੇਤਾਂ ਵਿੱਚ ਜਾ ਕੇ ਦੇਖੋਗੇ ਇੱਥੇ ਪਿੰਡ ਦੇ ਸਾਰੇ ਲੋਕ ਸੈਰ ਕਰਨ ਜਾਂਦੇ ਨੇ ਖੇਤਾਂ ਵਿੱਚ ਉੱਥੇ ਠੰਡੀਆਂ ਠੰਡੀਆਂ ਹਵਾ ਦਾ ਆਨੰਦ ਮਾਣਦੇ ਹਨ ਅਤੇ ਇੱਥੇ ਪੰਛੀ ਵਗੈਰਾ ਜਾਨਵਰ ਹੋ ਗਏ ਉਹ ਵੀ ਸ਼ਾਮ ਨੂੰ ਉਹਨਾਂ ਦਾ ਵੀ ਅਦਭੁਤ ਨਜ਼ਾਰਾ ਹੀ ਹੁੰਦਾ ਹੈ ਦੇਖਣ ਦਾ